ਮੈਂ ਨਵਾਂਸ਼ਹਿਰ ਦੇ ਕੋਲ ਪਿੰਡ ਰੈਲ ਮਾਜਰੇ ਦੇ ਕੋਲ ਰਹਿੰਦੀ ਹਾਂ ਅਤੇ ਮੈਂ ਸਕੂਲ ਆਸਰੋਂ ਪੜ੍ਹਨ ਜਾਂਦੀ ਹਾਂ ਉੱਥੇ ਮੈਂ ਰੋਜ਼ ਆਉਂਦੀ ਜਾਂਦੀ ਹਾਂ ਅਤੇ ਜਿਹੜੀ ਮੇਰੀ ਸਹੇਲੀ ਦਾ ਘਰ ਆ ਉਹ ਟੌਂਸੇ ਹੈ ਉੱਥੇ ਮੈਂ ਕਦੇ ਕਦੇ ਪੜ੍ਹਨ ਲਈ ਚਲੀ ਜਾਂਦੀ ਹਾਂ ਜਿਵੇਂ ਕਿ ਸੰਡੇ ਛੁੱਟੀ ਹੋਵੇ ਜਾਂ ਫਿਰ ਕੋਈ ਹੋਰ ਦਿਨ ਦੀ ਛੁੱਟੀ ਆ ਜਾਂਦੀ ਆ ਅਤੇ ਜੇ ਅਸੀਂ ਦੁੱਧ ਲੈਣ ਜਾਂਦੇ ਆ ਪ੍ਰੇਮ ਨਗਰ ਜਾਂਦੇ ਆ ਉੱਥੇ ਜਾਣ 'ਚ ਪਹਿਲੇ ਜੋ ਪਹਿਲੇ ਦੇ ਟਾਈਮ 'ਚ ਦੇਖੀਏ ਤਾਂ ਉੱਥੇ ਸੜਕਾਂ ਬਹੁਤ ਕੱਚੀਆਂ ਹੁੰਦੀਆਂ ਸੀ ਹੁਣ ਤਾਂ ਸੜਕਾਂ ਬਣ ਗਈਆਂ ਅਤੇ ਆਵਾਜਾਈ ਦੇ ਵੀ ਸਾਧਨ ਹੋ ਗਏ ਹੈ ਜਿਸ ਦੇ ਕਾਰਨ ਟਾਈਮ ਵੀ ਘੱਟ ਲੱਗ ਜਾਂਦਾ ਏ ਅਤੇ ਪਹਿਲੇ ਬਹੁਤ ਜ਼ਿਆਦਾ ਲੱਗਦਾ ਸੀ